ਮੈਂ ਦੋ ਹਜ਼ਾਰ ਦੇ ਵਿੱਚ ਪਹਿਲੀ ਮਾਰਚ ਨੂੰ ਪੰਜਾਬ ਗੌਰਮਿੰਟ ਦੇ ਅੰਡਰ ਏਡਿਡ ਸਕੂਲ ਦੇ ਵਿੱਚ ਐਜ਼ ਪ੍ਰਿੰਸੀਪਲ ਚਾਰਜ ਸੰਭਾਲਿਆ ਉਸ ਵੇਲੇ ਜੋ ਪੰਜਾਬ ਦੀ ਵਿੱਦਿਅਕ ਖੇਤਰ ਸੀ ਉੱਥੇ ਨਕਲਾਂ ਦਾ ਬਹੁਤ ਜ਼ੋਰ ਸੀ ਕੋਈ ਸਕੂਲ ਇੱਕ ਦੂਜੇ ਤੋਂ ਵੱਧ ਕੇ ਨਕਲ ਕਰਾਂਦਾ ਸੀ ਵੀ ਮੇਰੇ ਬੱਚੇ ਵੱਧ ਤੋਂ ਵੱਧ ਨੰਬਰ ਲੈਣ ਵੱਧ ਤੋਂ ਵੱਧ ਪਾਸ ਹੋਣ ਚਾਹੇ ਉਨ੍ਹਾਂ ਨੂੰ ਕੁਛ ਆਉਂਦਾ ਚਾਹੇ ਨਹੀਂ ਆਉਂਦਾ ਉਹ ਗਲਤ ਜੋ ਤਰੀਕੇ ਸੀ ਨਕਲ ਦੇ ਕਿਤਾਬਾਂ ਦੇ ਕੇ ਪਰਚੀਆਂ ਦੇ ਕੇ ਨਕਲਾਂ ਕਰਾ ਕਰਾ ਕੇ ਈਵਨ ਕਈ ਸਕੂਲ ਤਾਂ ਬਾਹਰ ਕੌਸ਼ਨ ਪੇਂਪਰ ਬਾਹਰ ਕਢਵਾ ਕੇ ਮਾਈਕ ਲਗਾ ਦਿੰਦੇ ਤੇ ਲਉ ਵੀ ਲਿਖੋ ਕਯਾ ਕਯਾ ਪ੍ਰਸ਼ਨ ਹੈ ਪਹਿਲੇ ਨੰਬਰ ਦਾ ਆਹ ਉੱਤਰ ਹੈ ਦੂਜੇ ਨੰਬਰ ਦਾ ਇਹ ਹੈ ਮੈਨੂੰ ਇੱਕ ਗੱਲ ਯਾਦ ਆਈ ਇੱਕ ਸਕੂਲ ਦਾ ਨਾਮ ਤਾਂ ਨਹੀਂ ਮੈਂ ਲੈਣਾ ਲੋਕਲ ਹੀ ਸਕੂਲ ਸੀ ਸਾਡੇ ਰੋਪੜ ਦਾ ਉੱਥੇ ਟੀਚਰ ਬੋਲ ਕੇ ਪੇਪਰ ਕਰਵਾ ਰਿਹਾ ਸੀ ਪੇਪਰ ਚਾਰ ਸੈਟਾਂ 'ਚ ਆਉਂਦਾ ਸੀ ਏ ਬੀ ਸੀ ਡੀ ਔਰ ਟੀਚਰ ਨੇ ਪਹਿਲਾਂ ਬੱਚਿਆਂ ਨੂੰ ਕਿਹਾ ਵੀ ਲਉ ਵੀ ਏ ਵਾਲੇ ਲਿਖੋ ਉਨ੍ਹਾਂ ਨੇ ਲਿਖ ਲਿਆ ਕਹਿੰਦਾ ਲਉ ਵੀ ਹੁਣ ਬੀ ਵਾਲੇ ਲਿਖੋ ਉਨ੍ਹਾਂ ਨੇ ਲਿਖ ਲਿਆ ਫਿਰ ਕਹਿੰਦਾ ਸੀ ਵਾਲੇ ਲਿਖੋ ਉਹਨਾਂ ਨੇ ਵੀ ਲਿਖ ਲਿਆ ਫਿਰ ਕਹਿੰਦਾ ਲਉ ਵੀ ਡੀ ਵਾਲੇ ਲਿਖੋ ਬੱਚਿਆਂ ਨੇ ਸ਼ੋਰ ਮਚਾਤਾ ਉਹ ਕਹਿੰਦੇ ਸਰ ਸਾਡੇ ਤਾਂ ਸਿਰਫ਼ ਸੀ ਤੱਕ ਸ਼ੈਕਸਨ ਹੈ ਤੁਸੀਂ ਡੀ ਵਾਲਾ ਕਾਹਨੂੰ ਲਿਖਾਉਣ ਲੱਗ ਗਏ ਅਤੇ ਅਸੀਂ ਕਿ ਬੱਚਿਆਂ ਨੇ ਸ਼ੈਕਸ਼ਨ ਵਾਇਜ ਆਪਣੇ ਪੇਂਪਰ ਦੇ ਕੌਸ਼ਚਨ ਹੱਲ ਕਰਤੇ ਇਹ ਨਕਲ਼ ਚੱਲ ਰਹੀ ਸੀ ਲੇਕਿਨ ਮੈਂ ਜਿੱਦਣ ਦਾ ਪ੍ਰਿੰਸੀਪਲ ਬਣਿਆ ਮੈਂ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਨਕਲ ਬੰਦ ਕੀਤੀ ਕਿਉਂਕਿ ਨਕਲ ਦੇ ਸਹਾਰੇ ਪਾਸ ਹੋਏ ਬੱਚੇ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੇ ਔਰ ਨਕਲ ਕਰਨ ਦੇ ਰੋਕਣ ਦੇ ਲਈ ਮੈਂ ਆਪਣੇ ਟੀਚਰਾਂ ਨੂੰ ਕਿਹਾ ਜਿਹੜੇ ਟੀਚਰ ਦਾ ਜਿਸ ਦਿਨ ਪੇਪਰ ਹੋਏਗਾ ਉਹ ਉਸ ਦਿਨ ਸਕੂਲ ਨਹੀਂ ਆਏਗਾ ਜਦ ਉਸ ਸਬਜੇਕਟ ਦਾ ਟੀਚਰ ਹੀ ਨਹੀਂ ਤਾਂ ਨਕਲ ਕਿਸਨੇ ਕਰਵਾਉਣੀ ਅਤੇ ਇਸ ਤਰ੍ਹਾਂ ਨਕਲ ਰੋਕੀ ਔਰ ਉਹਦੇ ਨਾਲ ਬੱਚੇ ਜੋ ਹੈ ਚਾਰ ਵਾਰ ਪੰਜ ਵਾਰ ਮੇਰੇ ਪੰਜਾਬ ਦੇ ਵਿੱਚ ਨੰਬਰ ਵੱਨ 'ਤੇ ਆਏ ਔਰ ਮੈਰਿਟ ਵਧੀ ਲੋਕਾਂ ਦੀ ਲਿਆਕਤ ਵਧੀ ਆਪਣੇ ਆਪ ਉਹ ਕੋਈ ਬਚ ਕਈ ਬੱਚੇ ਤਾਂ ਆਈ ਆਈ ਟੀ ਵਿੱਚ ਵੀ ਗਏ ਔਰ ਕਈ ਬਹੁਤ ਮਿਲਟਰੀ ਦੇ ਬੜੇ ਬੜੇ ਅਹੁਦੇ ਪਰ ਸਿਲੈਕਟ ਹੋਏ ਤਾਂ ਜੋ ਲਿਆਕਤ ਤੀ ਉਸਦੇ ਸਾਹਮਣੇ ਨਕਲ ਕੋਈ ਕੰਮ ਨਹੀਂ ਕਰ ਸਕਦੀ ਔਰ ਇਸਨੂੰ ਮੈਂ ਅੱਜ ਵੀ ਲੋਕ ਇਸ ਗੱਲ ਦੀ ਸਾਡੀ ਸ਼ਲਾਘਾ ਕਰਦੇ ਹੈ ਕਿ ਬਈ ਤੁਸੀਂ ਇਹ ਕੰਮ ਕਰਿਆ ਔਰ ਮੈਨੂੰ ਵੇਖ ਕੇ ਹੋਰ ਸਕੂਲਾਂ ਨੇ ਵੀ ਇਹ ਕੰਮ ਕਰਨਾ ਸ਼ੁਰੂ ਕੀਤਾ